ਹੈਲੋ ਹਾਂਜੀ ਮੇਰੇ ਸਾਡੇ ਪੋਤੇ ਦੀ ਐਡਮਿਸ਼ਨ ਕਰਵਾਉਣੀ ਸਕੂਲ ਕੋਲ ਕਿਹੜਾ ਵਧੀਆ ਹੈਗਾ

ਏਟ ਕਲਾਸ ਕਰਾਉਣੀ ਹੈ ਸਕੂਲ ਕਿਹੜਾ ਵਧੀਆ ਇੱਥੇ ਦਾ

ਹਾਂਜੀ ਆਰਮੀ ਸਕੂਲ ਹੈ ਠੀਕ ਹੈ ਠੀਕ ਠੀਕ ਹੈ ਪੜ੍ਹਾਈ ਵਧੀਆ ਹੁੰਦੀ ਆ ਆਟੋ ਤਾਂ ਜਾਂਦਾ ਕਿ ਬੱਸ 'ਤੇ ਜਾਂਦਾ ਵੈਨਾਂ ਲੱਗੀਆਂ ਹੋਈਆਂ ਪੜ੍ਹਾਈ ਸਹੀ ਹੁੰਦੀ ਹੈ ਟਾਈਮ ਨਾਲ ਆ ਜਾਂਦਾ ਹਾਂਜੀ ਠੀਕ ਹੈ

ਸਟਾਫ ਵਧੀਆ ਸਟਾਫ ਵਧੀਆ ਸਟਾਫ ਵਧੀਆ ਪੜ੍ਹਾਈ ਵਧੀਆ

ਠੀਕ ਹੈ ਠੀਕ ਹੈ ਠੀਕ ਹੈ ਸਭ ਕੁਝ ਵਧੀਆ ਉੱਥੋਂ ਦਾ ਸਟਾਫ ਵੀ ਵਧੀਆ ਪੜ੍ਹਾਈ ਵੀ ਵਧੀਆ ਆਉਣ ਜਾਣ ਦੀ ਸੁਵਿਧਾ ਵੀ ਵਧੀਆ ਹਾਂ ਹਾਂਜੀ ਹਾਂਜੀ ਠੀਕ ਹੈ ਫਿਰ ਤਾਂ ਸਾਰਾ ਕੁਛ ਠੀਕ ਹੈ ਹਾਂਜੀ